ਅਸੀਂ ਆਪਣੇ ਜੀਵਨ ਵਿੱਚ ਜਦੋਂ ਵੀ ਘਰ ਦੇ ਵਿੱਚ ਕੋਈ ਚੰਗਾ ਕਰਮ ਹੁੰਦਾ ਹੈ ਬੱਚੇ ਦਾ ਜਨਮ ਹੁੰਦਾ ਹੈ ਜਾਂ ਬੱਚੇ ਦਾ ਵਿਆਹ ਹੁੰਦਾ ਹੈ ਅਤੇ ਅਸੀਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਓਟ ਆਸਰਾ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਸ਼ੁ ਕੰਮ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਫਿਰ ਜੇ ਵਿਆਹ ਸ਼ਾਦੀ ਹੈ ਜਾਂ ਹੋਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਤਾਂ ਗੁਰੂ ਸਾਹਿਬ ਨੂੰ ਆਪਣੇ ਘਰ ਲਿਆ ਕੇ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਵਾਉਂਦੇ ਹਾਂ ਅਤੇ ਉਸ ਤੋਂ ਅ ਭੋਗ ਪੈਣ ਤੋਂ ਉਪਰੰਤ ਅਸੀਂ ਜਿਹੜਾ ਵੀ ਕਾਰਜ ਹੈ ਉਹ ਅਸੀਂ ਸ਼ੁਰੂ ਕਰਦੇ ਹਾਂ ਕਿਉਂਕਿ ਗੁਰੂ ਸਾਹਿਬ ਦੇ ਹੁਕਮ ਤੋਂ ਬਗੈਰ ਅਸੀਂ ਨਹੀਂ ਚਲਦੇ ਕਿਉਂਕਿ ਉਹਨਾਂ ਨੂੰ ਸਾਡਾ ਸ਼ੁਕਰਾਨਾ ਕਰਨਾ ਬਣਦਾ ਹੈ ਅਤੇ ਫਿਰ ਅਸੀਂ ਕੰਮ ਦੀ ਸ਼ੁਰੂਆਤ ਕਰਦੇ ਹਾਂ ਜੀ